ਸਾਡਾ ਸਰੀਰ ਇੱਕ ਮਸ਼ੀਨ ਦੀ ਤਰ੍ਹਾਂ ਹੈ ਜਿੱਦਾਂ ਜਿੰਨਾ ਆਪਾਂ ਇਸ ਨੂੰ ਚਲਾਵਾਂਗੇ ਉਨਾ ਇਹ ਵਧੀਆ ਢੰਗ ਨਾਲ ਆਪਣੇ ਕੰਮਾਂਕਾਰਾਂ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਪੂਰਾ ਕਰ ਸਕਦਾ ਹੈ ਹੁਣ ਜੇਕਰ ਦੇਖਿਆ ਜਾਵੇ ਜਿਹੜੇ ਅੱਜ ਦੇ ਗਾਣੇ ਨੇ ਅੱਜ ਦੇ ਗਾਣਿਆਂ ਵਿੱਚ ਅਲੱਗ ਅਲੱਗ ਤਰੀਕੇ ਨਾਲ ਹਥਿਆਰ ਅਤੇ ਉਹਨਾਂ ਦਾ ਜਿਹੜੀ ਲਹਿਜਾ ਹੈ ਗਾਉਣ ਦਾ ਉਹਨਾਂ ਦਾ ਢੰਗ ਹੈ ਜਿਹੜਾ ਉਹ ਕੁਛ ਨਵੇਂ ਮੋਡਰਨ ਜਾਂ ਵੈਸਟਰਨ ਲੁੱਕ ਦੇ ਹਿਸਾਬ ਨਾਲ ਚੇਂਜ ਹੋ ਚੁੱਕੇ ਨੇ ਹੁਣ ਦੇਖਿਆ ਜਾਵੇ ਤਾਂ ਜਿਹੜਾ ਭੰਗੜਾ ਹੈ ਜਿੰਨਾ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕਸਰਤ ਕਰਦੇ ਹਾਂ ਜੇ ਆਪਾਂ ਉਹੀ ਕਸਰਤ ਨੂੰ ਆਪਾਂ ਕਿਸੇ ਗਾਣੇ ਦੇ ਨਾਲ ਕਰੀਏ ਤਾਂ ਉਹਦੇ ਵਿੱਚ ਪੰਜਾਹ ਪੰਜਾਹ ਤੋਂ ਸੌ ਪਰਸੈਂਟ ਵਾਧਾ ਹੋ ਜਾਂਦਾ ਹੈ ਇਹਨੂੰ ਮੈਂ ਖੁਦ ਵੀ ਅਪਣਾ ਕੇ ਦੇਖਿਆ ਹੈ ਕਿਉਂਕਿ ਜਦੋਂ ਆਪਾਂ ਕਿਸੇ ਕਸਰਤ ਨੂੰ ਮਤਲਬ ਜਿੱਦਾਂ ਮੈਂ ਸਵੇਰੇ ਉੱਠਿਆ ਤਾਂ ਸਵੇਰੇ ਉੱਠ ਕੇ ਮੈਨੂੰ ਲੱਗਦਾ ਕਿ ਅ ਕਸਰਤ ਅ ਮੈਨੂੰ ਕਰਨੀ ਚਾਹੀਦੀ ਹੈ ਅਤੇ ਮੈਂ ਕਸਰਤ ਕਰਨ ਲਈ ਉੱਠਦਾ ਵੀ ਹਾਂ ਅਤੇ ਕਸਰਤ ਕਈ ਵਾਰ ਇੱਦਾਂ ਹੁੰਦਾ ਵੀ ਮੇਰਾ ਮਨ ਨਹੀਂ ਹੈ ਕਰਨ ਦਾ ਤਾਂ ਮੈਂ ਕੀ ਕਰਦਾ ਮੈਂ ਭੰਗੜੇ ਦਾ ਕੋਈ ਵੀ ਸੌਂਗ ਆ ਜਿਹਦੇ ਵਿੱਚ ਗਾਣਾ ਚੱਲੇ ਸਹੀ ਤਰੀਕੇ ਨਾਲ ਮਤਲਬ ਸਹੀ ਗਾਣਾ ਹੋਵੇ ਢੋਲ ਦੀ ਤਾਨ ਹੋਵੇ ਹੈ ਨਾ ਜਿਹਦੇ 'ਤੇ ਪ੍ਰੋਪਰ ਸਟੈਪ ਚੱਕੇ ਜਾ ਸਕਣ ਅਤੇ ਆਪਣੇ ਸਰੀਰ ਦੀ ਪੂਰੀ ਕਸਰਤ ਹੋਵੇ ਇਹਦੇ ਨਾਲ ਕੀ ਹੁੰਦਾ ਸਾਡਾ ਅਸ ਮਾਨਸਿਕ ਵਿਕਾਸ ਵੀ ਹੁੰਦਾ ਹੈ ਸਾਡੇ ਵਿਚਾਰਾਂ 'ਚ ਵੀ ਨਵੀਆਂ ਚੀਜ਼ਾਂ ਆਉਂਦੀਆਂ ਨੇ ਅਤੇ ਆਪਣਾ ਜਿਹੜਾ ਸਰੀਰ ਆ ਉਹ ਸਹੀ ਢੰਗ ਨਾਲ ਅ ਕਸਰਤ ਵੀ ਕਰ ਲੈਂਦਾ ਅਤੇ ਸਮੇਂ ਨਾਲ ਕਰ ਲੈਂਦਾ ਅਤੇ ਆਪਾਂ ਉਸ ਦੇ ਗਾਣਿਆਂ ਦੇ ਉੱਤੇ ਆਪਾਂ ਸਹੀ ਤਰੀਕੇ ਨਾਲ ਕੰਮ ਜਿਹੜੀ ਕਸਰਤ ਆ ਉਹ ਕਰ ਸਕਦੇ ਹਾਂ ਤਾਂ ਇਸ ਮੇਰਾ ਮੰਨਣਾ ਇਹ ਆ ਵੀ ਜਿਹੜਾ ਕਸਰਤ ਹੈ ਉਹ ਭੰਗੜਾ ਹੋਵੇ ਚਾਹੇ ਕੋਈ ਹੋਰ ਇਕ ਹੋਰ ਗਾਣਾ ਹੋਵੇ ਤਾਂ ਉਹਨਾਂ 'ਤੇ ਗਾਣਿਆਂ 'ਤੇ ਆਪਾਂ ਜਦੋਂ ਕਰਦੇ ਹਾਂ ਤਾਂ ਜਿਹੜੀ ਐਫੀਸ਼ੈਂਸੀ ਆ ਐਫੀਸ਼ੈਂਸੀ ਮਤਲਬ ਆਪਣੇ ਜਿਹੜੀ ਅ ਪ੍ਰੋਡਕਟੀਵਿਟੀ ਆ ਉਹ ਥੋੜ੍ਹੀ ਜਿਹੀ ਵੱਧ ਜਾਂਦੀ ਆ ਹਰ ਇੱਕ ਐਕਸਰਸਾਈਜ਼ ਦੇ ਨਾਲ